ਮਾਈਗ੍ਰੇਸ਼ਨ ਕਰਦੇ ਹੋਏ ਪੰਛੀ ਮਨ ਨੂੰ ਬੜੇ ਚੰਗੇ ਲੱਗਦੇ ਹਨ ਮਨ ਨੂੰ ਬਹੁਤ ਹੀ ਭਾਉਂਦੇ ਹਨ ਇਹ ਸਾਈਬੇਰੀਆ ਮੰਗੋਲੀਆ ਰੂਸ ਅਤੇ ਹੋਰ ਕਈ ਦੂਰ ਦੁਰਾਡੇ ਇਲਾਕਿਆਂ ਤੋਂ ਪੰਜਾਬ ਦੇ ਅੰਮ੍ਰਿਤਸਰ ਹਰੀਕੇ ਪੱਤਣ ਵੱਲ ਨੂੰ ਉਹ ਆਪਣੀ ਮਾਈਗ੍ਰੇਸ਼ਨ ਕਰਦੇ ਹਨ ਇਹ ਇਨ੍ਹਾਂ ਝੀਲਾਂ 'ਤੇ ਆ ਕੇ ਬਹੁਤ ਖੁਸ਼ ਹੁੰਦੇ ਹਨ ਓਥੋਂ ਦਾ ਵਾਤਾਵਰਨ ਜਦੋਂ ਇਨ੍ਹਾਂ ਦੇ ਮਨ ਨੂੰ ਜਾਂ ਇਨ੍ਹਾਂ ਦੀ ਰਹਿਣ ਬਹਿਣ ਨੂੰ ਭਾਉਂਦਾ ਨਹੀਂ ਤਾਂ ਇਹ ਇਹ ਉੱਡ ਕੇ ਦੂਸਰੇ ਦੇਸ਼ਾਂ ਨੂੰ ਜਾਂਦਾ ਹੈ ਇਸ ਦਾ ਅਨੁਭਵ ਇਹ ਹੁੰਦਾ ਹੈ ਕਿ ਇਨਸਾਨ ਦੀ ਜ਼ਿੰਦਗੀ ਵਿੱਚ ਬਦਲਾਵ ਬਹੁਤ ਜ਼ਰੂਰੀ ਹੈ ਇਹ ਆਪਣੀ ਏਕਤਾ ਦਾ ਪ੍ਰਗਟਾਵਾ ਆਪਣੇ ਝੁੰਡਾਂ ਤੋਂ ਕਰਦੇ ਹਨ ਇਸ ਤੋਂ ਸਾਨੂੰ ਅਹਿਸਾਸ ਹੋਣਾ ਚਾਹੀਦਾ ਹੈ ਕਿ ਮਿਲ ਜੁਲ ਕੇ ਰਹਿਣ ਨਾਲ ਨਾ ਅਸੀਂ ਸਮੇਂ ਦੇ ਆਉਣ ਵਾਲੇ ਤਬਦੀਲੀਆਂ ਨੂੰ ਵੀ ਸਹਿ ਸਕਦੇ ਹਾਂ ਮਿਲ ਜੁਲ ਕੇ ਚੱਲਣ ਦੇ ਨਾਲ ਹਰ ਮੁਸੀਬਤ ਦਾ ਸਾਹਮਣਾ ਆਪ ਕਰਨਾ ਹੁੰਦਾ ਹੈ ਅਤੇ ਮੁੜ ਕੇ ਜਦੋਂ ਉਨ੍ਹਾਂ ਦੀ ਉਸ ਔਖੀ ਘੜੀ ਖਤਮ ਹੋ ਜਾਂਦੀ ਹੈ ਤਾਂ ਮੁੜ ਕੇ ਉਹ ਆਪਣੇ ਦੇਸਾਂ ਨੂੰ ਵਾਪਸ ਚਲੇ ਜਾਂਦੇ ਹਨ ਇਹ ਪੰਛੀ ਹੰਸ ਗੜਵਾਲ ਸਾਈਬੇਰੀਅਨ ਪ੍ਰੀ ਪ੍ਰੀਨ ਰੈੱਡ ਸ਼ਾਕ ਇਹ ਬਹੁਤ ਸਾਰੇ ਪੰਛੀ ਹਨ ਜੋ ਉਨ੍ਹਾਂ ਦੇਸ਼ਾਂ ਤੋਂ ਉੱਡ ਕੇ ਇੱਧਰ ਵੱਲ ਨੂੰ ਆਉਂਦੇ ਹਨ ਅੰਮ੍ਰਿਤਸਰ ਬਿਆਸ ਦੇ ਨੇੜੇ ਹਰੀਕੇ ਪੱਤਣ 'ਤੇ ਇਨ੍ਹਾਂ ਦਾ ਨਿਵਾਸ ਹੁੰਦਾ ਹੈ